ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਰੁਨਾ ਬੋਲ ਰਹੀ ਹਾਂ ਤੁਹਾਡੀ ਦੁਕਾਨ ਤੋਂ ਮੈਂ ਕਰੋਕਰੀ ਦਾ ਸਮਾਨ ਮੰਗਵਾਇਆ ਸੀ ਪਹਿਲੀ ਵਾਰੀ ਮੰਗਵਾਇਆ ਬਹੁਤ ਵਧੀਆ ਆਇਆ ਸੀ ਕੋਂਪਣੀ ਦਾ ਅਤੇ ਬਹੁਤ ਵਧੀਆ ਪ੍ਰਿੰਟ ਆਂਢੀਆਂ ਗੁਆਂਢੀਆਂ ਨੇ ਬੜੇ ਪਸੰਦ ਕੀਤੇ ਅਤੇ ਮੈਂ ਫੇਰ ਦੁਬਾਰਾ ਮੰਗਵਾਇਆ ਉਹ ਮ ਉਹ ਰਿਸ਼ਤੇਦਾਰ ਵੀ ਸਗੋਂ ਕਹਿੰਦੇ ਵੀ ਸਾਨੂੰ ਵੀ ਦੱਸੋ ਤੁਸੀਂ ਕਿੱਥੋਂ ਲਿਆਂਦਾ ਅਤੇ ਮੈਂ ਤੁਹਾਡੇ ਕੋਲੋਂ ਦੁਬਾਰਾ ਫੇਰ ਮੰਗਵਾਇਆ ਅਤੇ ਇਹ ਸਮਾਨ ਜਿਹੜਾ ਨਾ ਇਹ ਠੀਕ ਨਹੀਂ ਤੁਸੀਂ ਭੇਜਿਆ ਇੱਕ ਤਾਂ ਟੁੱਟਿਆ ਰਿਹਾ ਵਿੱਚੋਂ ਸਾਰਾ ਹੀ ਸਮਾਨ ਅਤੇ ਇੱਕ ਪ੍ਰਿੰਟ ਜਿਹੜਾ ਤੁਹਾਨੂੰ ਕਿਹਾ ਸੀ ਵੀ ਭੇਜਿਓ ਕਲਰ ਉਹ ਵੀ ਨਹੀਂ ਤੁਸੀਂ ਭੇਜਿਆ ਕਲਰ ਵੀ ਨਹੀਂ ਠੀਕ ਭੇਜਿਆ ਅਤੇ ਬਾਕੀ ਉਹ ਹੈ ਹੀ ਨਹੀਂ ਚੰਗਾ ਕਹਿੰਦੇ ਅਤੇ ਉਹਦੇ ਵਿੱਚੋਂ ਇਹ ਸਾਰਾ ਤਾਂ ਟੁੱਟਾ ਦਾ ਨਿਕਲਿਆ ਅਤੇ ਦੂਜੀ ਗੱਲ ਵੀ ਉਹ ਸਮਾਨ ਵੀ ਹਲਕਾ ਪਹਿਲਾ ਸੋ ਬਹੁਤ ਵਧੀਆ ਸੀ ਇਹ ਦੂਜੀ ਵਾਰੀ ਤਾਂ ਬਹੁਤ ਹਲਕਾ ਸਮਾਨ ਭੇਜਿਆ ਪਹਿਲੋਂ ਤੁਸੀਂ ਹਜ਼ਾਰ ਰੁਪਇਆ ਲਿਆ ਹੁਣ ਤੁਸੀਂ ਪੰਦਰ੍ਹਾਂ ਸੌ ਲਿਆ ਅਤੇ ਸਮਾਨ ਤੁਹਾਡਾ ਬਿਲਕੁਲ ਨਹੀਂ ਚੰਗਾ ਉਹ ਸਾਰੇ ਗੁੱਸੇ ਹੁੰਦੇ ਕਹਿੰਦੇ ਆ ਕਿੱਦਾਂ ਦਾ ਸਮਾਨ ਮੰਗਵਾ ਲਿਆ ਤੁਸੀਂ ਇਹਨੂੰ ਵਾਪਸ ਕਰੋ ਬੱਚੇ ਵੀ ਕਹਿੰਦੇ ਕਹਿੰਦੇ ਇਹ ਜਿਹੜਾ ਤੁਸੀਂ ਮੰਮੀ ਤੁਹਾਨੂੰ ਪਹਿਲੋਂ ਕਿਹਾ ਸੀ ਉਹਦੇ ਨਾਲ ਦਾ ਮੰਗਵਾਉਣਾ ਸੀ ਨਾ ਅਤੇ ਮੈਂ ਤਾਂ ਤੁਹਾਨੂੰ ਉਹੀ ਕਿਹਾ ਅਤੇ ਤੁਸੀਂ ਉਹ ਤੁਸੀਂ ਦੂਜਾ ਭੇਜਤਾ ਅਤੇ ਇੱਕ ਟੁੱਟਿਆ ਦਾ ਭੇਜਿਆ ਸਾਰਾ ਹੀ ਅਤੇ ਉਹ ਹੁਣ ਵਾਪਸ ਕਰੋ ਅਤੇ ਸਾਡੇ ਪੈਸੇ ਵਾਪਸ ਦੇ ਦਿਉ ਅਤੇ ਨਹੀਂ ਤਾਂ ਆਣ ਕੇ ਅਤੇ ਸਮਾਨ ਸਾਨੂੰ ਚੇਂਜ ਕਰਕੇ ਦੂਜਾ ਉਹ ਦਿਓ ਸੈੱਟ ਕਰੋਕੜੀ ਦਾ ਦੂਜਾ ਸੈੱਟ ਭੇਜੋ ਵਧੀਆ ਨਹੀਂ ਤਾਂ ਵਾਪਸ ਕਰ ਦਿਉ ਅਤੇ ਅਸੀਂ ਕੀ ਫਾਇਦਾ ਫੇਰ ਤੁਹਾਡੇ ਕੋਲੋਂ ਸਮਾਨ ਲੈਣ ਦਾ ਅਤੇ ਤੁਸੀਂ ਉਹਨੂੰ ਵਾਪਸ ਕਰੋ